ਮੈਂ ਬਹੁਤ ਟਾਈਮ ਤੋਂ ਇੱਕ ਵਧੀਆ ਟੀਵੀ ਖਰੀਦਣ ਦੀ ਲਾਭ ਵਿੱਚ ਸਾਂ ਕਿਉਂਕਿ ਸਾਡੇ ਘਰ ਦੇ ਵਿੱਚ ਬਹੁਤ ਦੇਰ ਤੋਂ ਟੀਵੀ ਨਹੀਂ ਸੀਗਾ ਅਤੇ ਮੈਨੂੰ ਸੀਰੀਅਲ ਦੇਖਣ ਦਾ ਬਹੁਤ ਸ਼ੌਂਕ ਹੈ ਤਾਂ ਕਿ ਮੈਂ ਇੱਕ ਟੀਵੀ ਖਰੀਦਣਾ ਚਾਹੁੰਦੀ ਸੀ ਅਤੇ ਮੈਨੂੰ ਕਿਸੇ ਨੇ ਸੁਝਾਅ ਦਿੱਤਾ ਕਿ ਆਨਲਾਈਨ ਸ਼ਾਪਿੰਗ ਵੀ ਚੰਗੀ ਹੁੰਦੀ ਹੈ ਪਰ ਮੈਂ ਆਫਲਾਈਨ ਸ਼ੋਪਿੰਗ 'ਤੇ ਜ਼ਿਆਦਾ ਭਰੋਸਾ ਕਰਦੀ ਹਾਂ ਕਿਉਂਕਿ ਆਨਲਾਈਨ ਸ਼ਾਪਿੰਗ ਦੇ ਵਿੱਚ ਇੱਦਾਂ ਹੁੰਦਾ ਹੈ ਕਿ ਜਦੋਂ ਆਪਾਂ ਆਨਲਾਈਨ ਖਰੀਦਦਾਰੀ ਕਰਦੇ ਹਾਂ ਤਾਂ ਕੁਛ ਸਮਾਨ ਆਪਾਂ ਨੂੰ ਸਹੀ ਨਹੀਂ ਮਿਲਦਾ ਜਾਂ ਫਿਰ ਕੁਛ ਖਰਾਬ ਆਪਾਂ ਨੂੰ ਰਿਸੀਵ ਹੋ ਜਾਂਦਾ ਹੈ ਸਮੇਂ 'ਤੇ ਕੁਛ ਰੇਟ ਉੱਪਰ ਥੱਲੇ ਹੋ ਜਾਂਦੇ ਹਨ ਡਿਲੀਵਰੀ ਸਹੀ ਟਾਈਮ 'ਤੇ ਨਹੀਂ ਪਹੁੰਚਦੀ ਬਟ ਆਫਲਾਈਨ ਦੇ ਵਿੱਚ ਇੱਦਾਂ ਹੁੰਦਾ ਕਿ ਆਪਾਂ ਆਪ ਸਟੋਰ 'ਤੇ ਜਾ ਕੇ ਖਰੀਦਦਾਰੀ ਕਰਦੇ ਹਾਂ ਆਪਣੇ ਹੱਥਾਂ ਨਾਲ ਚੀਜ਼ ਨੂੰ ਮਹਿਸੂਸ ਕਰਕੇ ਦੇਖ ਕੇ ਅਤੇ ਉਹਦੀ ਜਾਂਚ ਪੜਤਾਲ ਕਰ ਕਰਕੇ ਡਿਸਕਾਊਂਟ ਕਰਵਾ ਕੇ ਰੇਟ ਦਾ ਅਤੇ ਫਿਰ ਹੀ ਆਪਾਂ ਚੀਜ਼ਾਂ ਨੂੰ ਖਰੀਦਦੇ ਹਾਂ ਅਤੇ ਮੈਂ ਕੀਮਤਾਂ ਦੀ ਜਾਂਚ ਬਹੁਤ ਚੰਗੀ ਤਰ੍ਹਾਂ ਕਰਦੀ ਹਾਂ ਹਰ ਇੱਕ ਚੀਜ਼ ਨੂੰ ਖਰੀਦਣ ਲੱਗੇ ਤਾਂ ਕਿ ਟੀਵੀ ਨੂੰ ਖਰੀਦਣ ਲੱਗੇ ਵੀ ਮੈਂ ਬਹੁਤ ਚੰਗੀ ਤਰ੍ਹਾਂ ਜਾਂਚ ਕੀਤੀ ਅਤੇ ਬਹੁਤ ਚੰਗੇ ਦਾਮ 'ਤੇ ਅਤੇ ਬਹੁਤ ਚੰਗੀ ਦੁਕਾਨ ਤੋਂ ਇੱਕ ਸੈਮਸੰਗ ਸਟੋਰ ਤੋਂ ਮੈਂ ਇੱਕ ਬੱਤੀ ਇੰਚੀ ਐਲਈਡੀ ਸੈਮਸੰਗ ਦੀ ਖਰੀਦੀ ਜਿਹੜੀ ਕਿ ਹੁਣ ਮੇਰੇ ਕਮਰੇ ਵਿੱਚ ਲੱਗੀ ਹੈ ਅਤੇ ਬਹੁਤ ਹੀ ਜ਼ਿਆਦਾ ਚੰਗਾ ਵਿਊ ਦਿੰਦੀ ਹੈ ਅਤੇ ਆਨਲਾਈਨ ਦੀ ਬਜਾਏ ਮੈਂ ਆਫਲਾਈਨ ਨੂੰ ਜ਼ਿਆਦਾ ਪ੍ਰੈਫਰ ਕਰਦੀ ਹਾਂ